ਇੱਕ ਬਾਈਕਰ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਜਿਵੇਂ ਕਿ ਮੇਰਾ ਬਾਈਕ ਬਾਈਕ ਸਭ ਤੋਂ ਪਹਿਲਾਂ ਮੈਂ ਆਪਣੀ ਬਾਈਕ ਦੀ ਮੈਨਟੇਨੈਂਸ ਬਾਰੇ ਗੱਲ ਕਰਦਾ ਹਾਂ ਉਸ ਨੂੰ ਬਹੁਤ ਵਧੀਆ ਬਹੁਤ ਸੋਹਣੇ ਤਰੀਕੇ ਨਾਲ ਰੱਖਿਆ ਹੁੰਦਾ ਹੈ ਸਭ ਤੋਂ ਪਹਿਲਾਂ ਉਹਦੀ ਸਰਵਿਸ ਵੱਲ ਧਿਆਨ ਦੇਣਾ ਹੁੰਦਾ ਹੈ ਕੋਈ ਚੀਜ਼ ਖਰਾਬ ਨਾ ਹੋਵੇ ਸਾਰੀਆਂ ਲਾਈਟਾਂ ਪੂਰੀਆਂ ਹੋਣ ਜਿਹਦੇ ਕਾਰਨ ਸਾਡਾ ਟਰੈਫਿਕ ਦਾ ਚਲਾਨ ਨਾ ਕੱਟਿਆ ਜਾਵੇ ਉਸ ਤੋਂ ਬਾਅਦ ਜਦੋਂ ਅਸੀਂ ਬਾਈਕ ਚਲਾਨੇ ਹਾਂ ਓਨ ਰੋਡ ਹੁੰਦੇ ਹਾਂ ਉਹਦੇ ਦੌਰਾਨ ਅਸੀਂ ਇਹ ਮੈਂ ਇਹ ਦੇਖਦਾ ਵਾਂ ਜਿਵੇਂ ਅਸੀਂ ਰੈ ਰੈਡ ਲਾਈਟ 'ਤੇ ਰੁਕਣਾ ਹੁੰਦਾ ਹੈ ਨਾ ਕਿ ਅਸੀਂ ਰੈਡ ਲਾਈਟ ਕ੍ਰੋਸ ਕਰਨੀ ਹੁੰਦੀ ਹੈ ਰਾਈਟ ਮੁੜਨਾ ਅਤੇ ਰਾਈਟ ਇੰਡੀਕੇਟਰ ਵੀ ਦੇਣਾ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਇਹ ਦੇਖ ਕੇ ਹੀ ਬਾਈਕ ਵਧੀਆ ਚੱਲਦੀ ਹੈ ਇਹ ਮਤਲਬ ਕਿ ਜਿਸ ਤਰ੍ਹਾਂ ਅਸੀਂ ਅੱਗੇ ਨਿਕਲਦੇ ਹਾਂ ਤੇਜ਼ ਸਪੀਡ ਨਹੀਂ ਚਲਾਉਣੀ ਸਪੀਡ ਲਿਮਿਟ ਰੱਖਣੀ ਹੁੰਦੀ ਹੈ ਜੇ ਛੋਟੀ ਸੜਕ ਹੈ ਅਤੇ ਛੋਟੀ ਵੀਹ ਤੀਹ ਦੀ ਸਪੀਡ ਰੱਖੋ ਜੇ ਹਾਈਵੇ ਹੈ ਅਤੇ ਫਿਰ ਚਾਲ੍ਹੀ ਪੰਜਾਹ ਦੀ ਸਪੀਡ ਰੱਖੋ ਇਹਦੇ ਦੌਰਾਨ ਤੁਹਾਡਾ ਕੋਈ ਐਕਸੀਰੈਂਟ ਵੀ ਨਹੀਂ ਹੋਏਗਾ ਕੋਈ ਹਮੇਸ਼ਾ ਸ਼ੀਸ਼ੇ ਗਿਲਾਸ ਲੱਗੇ ਹੋਣੇ ਚਾਹੀਦੇ ਨੇ ਰਾਈਟ ਲੈਫਟ ਜਿਹਦੇ ਨਾਲ ਸਾਨੂੰ ਪਿੱਛੇ ਦੀ ਵੀ ਸਮਝ ਆ ਸਕੇ ਕਿ ਕੋਈ ਵੱਡੀ ਵਹੀਕਲ ਤਾਂ ਨਹੀਂ ਆ ਰਹੀ